ਜਦੋਂ ਪਹਿਲੀ ਵਾਰੀ ਮੈਂ ਡਰੋਨ ਔਪਰੇਟ ਕਰਨ ਲੱਗਿਆ ਤਾਂ ਮੇਰੇ ਕੋਲੋਂ ਡਰੋਨ ਔਪਰੇਟ ਨਹੀਂ ਹੋਇਆ ਉਹ ਫਲਾਇੰਗ ਕਰਦਾ ਕਰਦਾ ਨੀਚੇ ਗਿਰਨ ਲੱਗਿਆ ਸੀ ਤਾਂ ਬੜੀ ਮੁਸ਼ਕਲ ਨਾਲ ਮੈਂ ਉਹਨੂੰ ਕੰਟਰੋਲ ਕਰਕੇ ਲੈਂਡ ਕਰਾ ਦਿੱਤਾ ਫੇਰ ਬਾਅਦ ਵਿੱਚ ਮੈਂ ਆਪਣੇ ਦੋਸਤ ਨੂੰ ਫ਼ੋਨ ਕਰਕੇ ਬੁਲਾਇਆ ਤਾਂ ਉਸਨੇ ਮੈਨੂੰ ਸਮਝਾਇਆ ਵੀ ਇਹਨੂੰ ਕਿੱਦਾਂ ਕਿੱਦਾਂ ਅਪਰੇਟ ਕਰਨਾ ਹੈ ਅਤੇ ਕਿੱਦਾਂ ਇਹਦੇ 'ਤੇ ਵਰਕ ਕਰਨਾ ਹੈ ਅਤੇ ਹੌਲੀ ਹੌਲੀ ਔਪਰੇਟਿੰਗ ਕਰਦਾ ਗਿਆ ਮੈਂ ਹੁਣ ਉਸ ਵਿੱਚ ਮੈਂ ਪੂਰਾ ਐਕਸਪਰਟ ਹੋ ਗਿਆ ਅਤੇ ਕੁਛ ਚੀਜ਼ਾਂ ਮੈਂ ਇੰਟਰਨੈਟ ਤੋਂ ਵੀ ਸਿੱਖੀਆਂ ਨੇ ਥੈਂਕ ਯੂ